ਹਾਂ ਮੈਂ ਕਾਫੀ ਕਵਿਤਾਵਾਂ ਤੋਹਫੇ ਵਜੋਂ ਲਿਖੀਆਂ ਜਿਵੇਂ ਕਿ ਬਚਪਨ ਤੋਂ ਹੀ ਮੈਨੂੰ ਕਵਿਤਾ ਲਿਖਣ ਦਾ ਪੜ੍ਹਨ ਦਾ ਕਾਫੀ ਸ਼ੌਂਕ ਸੀ ਜਿਉਂ ਜਿਉਂ ਮੈਂ ਕਵਿਤਾ ਪੜ੍ਹਦਾ ਰਿਹਾ ਜਿਵੇਂ ਕਿ ਅੰਮ੍ਰਿਤਾ ਪ੍ਰੀਤਮ ਅਤੇ ਹੋਰ ਚੰਗੇ ਕਵੀ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੜ੍ਹੀਆਂ ਮੇਰੇ ਮਨ ਦੇ ਵਿੱਚ ਹੋਰ ਉਤਸ਼ਾਹ ਬਣਿਆ ਕਿ ਮੈਂ ਕਵਿਤਾਵਾਂ ਲਿਖਾਂ ਲੋਕਾਂ ਦੇ ਵਿੱਚ ਜਾ ਕੇ ਬੋਲਾਂ ਜਿਹਦੇ ਤੋਂ ਮੈਨੂੰ ਥੋੜ੍ਹਾ ਉਤਸਾਹ ਮਿਲਦਾ ਸੀਗਾ ਅਤੇ ਉਤਸਾਹ ਦੇ ਨਾਲ ਮੈਂ ਜੋ ਕਾਫੀ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਹੈ ਨਾ ਆਪਾਂ ਜਨਮ ਦਿਨ ਦੀ ਪਾਰਟੀ 'ਤੇ ਗਏ ਸੀਗੇ ਕਿਸੇ ਦੇ ਘਰ ਅਤੇ ਬੱਚੇ ਦੇ ਜਨਮਦਿਨ ਦੇ ਉੱਤੇ ਮੈਂ ਇੱਕ ਕਵਿਤਾ ਸੁਣਾਈ ਜਿਹਨੂੰ ਲੋਕਾਂ ਨੇ ਬਹੁਤ ਜ਼ਿਆਦਾ ਸਲਾਹਿਆ ਬਹੁਤ ਤਾਰੀਫ ਕੀਤੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜਿਹੜੀ ਤੁਸੀਂ ਕਵਿਤਾ ਸਾਨੂੰ ਸੁਣਾਈ ਆ ਨਾ ਇਹ ਸਾਡੇ ਬੱਚੇ ਦੇ ਜਨਮਦਿਨ 'ਤੇ ਇੱਕ ਤੋਹਫਾ ਵਾ ਇੱਕ ਤੋਹਫੇ ਦੇ ਵਜੋਂ ਹੀ ਉਹ ਜਿਹੜੀ ਸੀਗੀ ਕਵਿਤਾ ਹੋ ਗਈ ਅਤੇ ਇਸ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ